ਫਿਲਮਾਂ ਸਾਡੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ ਜਿਵੇਂ ਕਿ ਬੋਲੀਵੁੱਡ ਫਿਲਮਾਂ ਦੇ ਵਿੱਚ ਹੀਰੋ ਹੀਰੋਇਨਸ ਨੇ ਅਲੱਗ ਅਲੱਗ ਤਰ੍ਹਾਂ ਦੇ ਕੱਪੜੇ ਪਾਏ ਹੁੰਦੇ ਹਨ ਅਤੇ ਉਹ ਕੱਪੜੇ ਸਾਡੇ ਟੀਨਏਜ਼ਰ ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਪਾਉਣਾ ਪਸੰਦ ਕਰਦੇ ਹਨ ਪਰ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਤਾਂ ਸਿਰਫ ਪਰਦੇ ਦੇ ਉੱਤੇ ਆ ਰਹੇ ਨੇ ਪਰ ਜਦੋਂ ਬੱਚੇ ਛੋਟੇ ਕੱਪੜੇ ਪਾ ਕੇ ਸੋਸ਼ਲ ਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਵੱਖਰੀ ਨਿਗ੍ਹਾ ਦੇ ਨਾਲ ਦੇਖਿਆ ਜਾਂਦਾ ਹੈ ਬੱਚਿਆਂ ਨੂੰ ਹਮੇਸ਼ਾ ਉਸ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਚਾਹੀਦਾ ਹੈ ਜੋ ਕਿ ਸੋਸ਼ਲ ਸੋਸ਼ਲੀ ਅਸੈਪਟੇਬਲ ਹੋਵੇ ਫਿਲਮਾਂ ਦੇ ਵਿੱਚ ਜਿਵੇਂ ਕਿ ਹੀਰੋਇਨ ਵਿਦਿਆ ਬਾਲਨ ਬਹੁਤ ਹੀ ਅੱਛੀ ਡਰੈਸਿੰਗ ਸੈਂਸ ਆ ਉਹ ਜ਼ਿਆਦਾਤਰ ਉਹਨੂੰ ਸਾੜੀਆਂ ਦੇ ਵਿੱਚ ਦੇਖਿਆ ਜਾਂਦਾ ਹੈ ਅਤੇ ਮੈਨੂੰ ਉਹ ਬਹੁਤ ਹੀ ਪਸੰਦ ਹੈ ਉਸ ਨੂੰ ਮੈਂ ਕੋਪੀ ਤਾਂ ਨਹੀਂ ਕਹਾਂਗੇ ਪਰ ਉਸ ਦਾ ਕੋਈ ਵੀ ਕਰੈਕਟਰ ਜਦੋਂ ਉਹ ਕਿਸੇ ਫਿਲਮ ਦੇ ਵਿੱਚ ਪਲੇ ਕਰਦੀ ਹੈ ਤਾਂ ਮੈਨੂੰ ਵਧੀਆ ਲੱਗਦਾ ਹੈ ਜੇ ਆਪਾਂ ਹੀਰੋ ਦੀ ਗੱਲ ਕਰੀਏ ਤਾਂ ਰਣਵੀਰ ਕਪੂਰ ਉਹ ਵੀ ਉਹਦੀ ਵੀ ਡਰੈਸਿੰਗ ਸੈਂਸ ਥੋੜ੍ਹੀ ਅਲੱਗ ਹੁੰਦੀ ਹੈ ਅਤੇ ਮੇਰਾ ਕਹਿਣ ਦਾ ਮਤਲਬ ਇੱਥੇ ਇਹ ਹੈ ਕਿ ਇੱਕ ਬਹੁਤ ਹੀ ਪ੍ਰਚਲਿਤ ਕਹਾਵਤ ਹੈ ਕਿ ਖਾਉ ਮਨ ਭਾਉਂਦਾ ਅਤੇ ਪਾਉ ਜਗ ਭਾਉਂਦਾ ਮਤਲਬ ਜੋ ਸਾਰਿਆਂ ਨੂੰ ਪਸੰਦ ਹੋਵੇ ਆਪਾਂ ਨੂੰ ਉਸ ਤਰ੍ਹਾਂ ਦੀ ਡਰੈਸਿੰਗ ਸੈਂਸ ਰੱਖਣੀ ਚਾਹੀਦੀ ਹੈ ਅਤੇ ਖਾਣਾ ਤਾਂ ਸਾਰਿਆਂ ਦਾ ਆਪਣੇ ਮਨ ਦਾ ਹੁੰਦਾ ਹੀ ਹੈ ਸੋ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਸਾਨੂੰ ਆਪਣੇ ਕੱਪੜੇ ਇਸ ਤਰ੍ਹਾਂ ਚੂਜ਼ ਕਰਨੇ ਚਾਹੀਦੇ ਹਨ ਕਿ ਉਹ ਸੋਸ਼ਲੀ ਅਸੈਪਟੇਬਲ ਹੋਣ ਨਾ ਕਿ ਉਸ ਤਰ੍ਹਾਂ ਕਿ ਜਿਹੜੇ ਕਿ ਆਪਣੇ ਬੋਲੀਵੁੱਡ ਦੇ ਹੀਰੋ ਹੀਰੋਇਨ ਫਿਲਮਾਂ ਦੇ ਵਿੱਚ ਆਪਾਂ ਨੂੰ ਦਿਖਾਉਂਦੇ ਹਨ